ਹੈਲੋ ਜੀ ਹਾਂਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਜੀ ਪਬਲਿਕ ਟਰਾਂਸਪੋਰਟ ਦਾ ਅੱਜ ਕੱਲ੍ਹ ਕੀ ਹਾਲ ਹੈ ਮੈਂ ਤਾਂ ਬਹੁਤ ਔਖਾ ਹੋ ਰਿਹਾ ਹਾਂ ਜੀ ਤੁਸੀਂ ਸੁਣਾਓ ਕੀ ਬੱਸਾਂ ਚੱਲਦੀਆਂ ਸਹੀ ਤਰ੍ਹਾਂ ਨਾਲ ਤਰਨ ਤਾਰਨ ਦੇ ਵਿੱਚ ਉਹੀ ਹਾਲ ਮੈਂ ਵੀ ਸੋਚਦਾ ਪਿਆ ਅੱਜ ਕੱਲ੍ਹ ਤਾਂ ਬਹੁਤ ਹੀ ਬੁਰਾ ਹਾਲ ਹੈ ਅੱਗੇ ਤਾਂ ਬੱਸ ਮਿਲ ਜਾਂਦੀ ਹੁਣ ਕਦੀ ਬੱਸ ਨਹੀਂ ਜਦੋਂ ਦਾ ਵੈਸੇ ਚੰਨੀ ਸਰਕਾਰ ਨੇ ਇਹ ਸ਼ੁਰੂ ਕੀਤਾ ਨਾ ਆਧਾਰ ਕਾਰਡ ਉਹ ਰੋਡਵੇਜ਼ ਵਾਲੇ ਤਾਂ ਬੱਸਾਂ ਹੀ ਨਹੀਂ ਰੋਕਦੇ ਹਾਂਜੀ ਹਾਂਜੀ ਉਹੀ ਤਾਂ ਮੈਂ ਹ ਹੈਰਾਨ ਹੋਣ ਡਿਆਂ ਹੁਣ ਦੇਖੋ ਜੀ ਜਦੋਂ ਲੋਂਗ ਰੂਟ 'ਤੇ ਹੁੰਦਾ ਚਲੋ ਅੱਗੇ ਬੜੀ ਛੇਤੀ ਬੱਸ ਮਿਲ ਜਾਂਦੀ ਹੈ ਅੱਜ ਕੱਲ੍ਹ ਉਹ ਵੀ ਨਹੀਂ ਮਿਲਦੀ ਜਾਂ ਤਾਂ ਫਿਰ ਬੱਸ ਫੜਨ ਕਿੱਧਰ ਜਾਈਏ ਦਸ ਹੁਣ ਇਹੀ ਅੰਮ੍ਰਿਤਸਰ ਵੱਲ ਵਾਲੇ ਪਾਸੇ ਭੱਜੀਏ ਅਸੀਂ ਤਰਨ ਤਾਰਨ ਦੇ ਰਹਿਣ ਵਾਲੇ ਵਾਸੀ ਹਾਂ ਉਹੀ ਨਾ ਉਹ ਅੱਜ ਕੱਲ੍ਹ ਵੈਸੇ ਇਹਨਾਂ ਨੇ ਦਿੱਕਤਾਂ ਪਾਈਆਂ ਹੋਈਆਂ ਕਿ ਉਹ ਬ ਬੱਸ ਅੱਡੇ 'ਤੇ ਨਹੀਂ ਖਿਲਾਰ ਦੇ ਅਤੇ ਉਹ ਬਾਹਰ ਹੀ ਬਾਹਰੋਂ ਬਾਹਰ ਹੀ ਸਵਾਰੀਆਂ ਚੜਾਈ ਬਹੁਤ ਦਿੱਕਤ ਹੈ ਜੀ ਅਤੇ ਜੀ ਮੈਂ ਤਾਂ ਵੇਖੋ ਜੀ ਹੁਣ ਕਿਤੇ ਵੀ ਕੰਮ ਜਾਣਾ ਹੁੰਦਾ ਜੀ ਜੇ ਹੋ ਗਈ ਖਡੂਰ ਸਾਹਿਬ ਪੱਟੀ ਜਾਣਾ ਹੋਵੇ ਮੈਂ ਤਾਂ ਦਿੱਕਤ 'ਚ ਹੀ ਫਸਿਆ ਰਹਿਨਾ ਪਹਿਲਾਂ ਮੈਂ ਅੱਧਾ ਅੱਧਾ ਘੰਟਾ ਦੇਖਦੇ ਰਹਿੰਦਾ ਕਿ ਬੱਸ ਆਏਗੀ ਅਤੇ ਚੱਲਾਂਗੇ ਪਰ ਕੰਮ ਹੁਣ ਦੱਸੋ ਹੁਣ ਮੈਂ ਕੰਮ ਕਾਰ 'ਤੇ ਜਾਣਾ ਸੀ ਅਤੇ ਮੈਂ ਤੁਹਾਨੂੰ ਕੀ ਦੱਸਾਂ ਬੱਸ ਹੀ ਨਹੀਂ ਮਿਲੀ ਅੱਜ ਮੈਂ ਲੇਟ ਹੀ ਹੋ ਗਿਆ ਕੰਮ ਤੋਂ ਦੱਸੋ ਜੀ ਅਗਲਾ ਤਾਂ ਕਹਿੰਦਾ ਨਾ ਟਾਈਮ 'ਤੇ ਪਹੁੰਚੋ ਜਿਨ ਵੇ ਕੀ ਕਰੀਏ ਹੁਣ ਦੱਸੋ

ਹਾਂਜੀ ਹਾਂਜੀ ਜੀ ਸ਼ੁਕਰੀਆ ਜੀ